ਸਤਿ ਸ਼੍ਰੀ ਅਕਾਲ ਜੀ ਤੁਸੀਂ ਲੱਕੀ ਢਾਬੇ ਤੋਂ ਬੋਲਦੇ ਆਂ ਅਸੀਂ ਨਾ ਔਡਰ ਕੀਤਾ ਸੀਗਾ ਥੋੜ੍ਹੇ ਟਾਈਮ ਪਹਿਲਾਂ ਅਤੇ ਹੁਣ ਮੇਰੇ ਯਾਰਾਂ ਦੋਸਤਾਂ ਨੂੰ ਕੋਈ ਕੰਮ ਪੈ ਗਿਆ ਅਤੇ ਕਈ ਵਿੱਚੋਂ ਆਉਣਾ ਨਹੀਂ ਕਿਸੇ ਨੇ ਤਾਂ ਔਡਰ ਘੱਟ ਕਰਨਾ ਸੀਗਾ ਪਹਿਲਾਂ ਔਡਰ ਕੀਤਾ ਸੀਗਾ ਚਾਰ ਕੜਾਈ ਪਨੀਰ ਤਿੰਨ ਰਾਈਤੇ ਪੰਜ ਦਾਲ਼ਾਂ ਅਤੇ ਸੱਠ ਰੋਟੀਆਂ ਅਤੇ ਹੁਣ ਇਹਨੂੰ ਕੱਟ ਕੇ ਤੁਸੀਂ ਦੋ ਕੜਾਈ ਪਨੀਰ ਕਰ ਦੋ ਤਿੰਨ ਦਾਲ਼ਾਂ ਦੋ ਰਾਈਤੇ ਤੀਹ ਰੋਟੀਆਂ ਅਤੇ ਬਾਕੀ ਗੂਗਲ ਪੇ ਜਾਂ ਪੇਟੀਐੱਮ ਚੱਲਦਾ ਹੋਏ ਤੁਹਾਡਾ ਤਾਂ ਕਿਊ ਆਰ ਕੋਡ ਭੇਜ ਦਿਉ ਬਾਕੀ ਤੁਹਾਡਾ ਖਾਣਾ ਬਹੁਤ ਸਵਾਦ ਹੁੰਦਾ ਹੈ ਮੈਂ ਕਸਟਮਰ ਤੁਹਾਡਾ ਪੁਰਾਣਾ ਆ ਧੰਨਵਾਦ